ਮੈਂ ਪਿਛਲੇ ਸਾਲ ਆਰਮੀ ਦੀ ਤਿਆਰੀ ਲਈ ਦੌੜ ਲਗਾਉਂਦਾ ਹੁੰਦਾ ਸੀ ਅਤੇ ਮੈਂ ਸਵੇਰੇ ਸਾਝਰੇ ਚਾਰ ਵਜੇ ਜਾਂਦਾ ਹੁੰਦਾ ਸੀਗਾ ਕੋਚ ਕੋਲ ਟ੍ਰੇਨਿੰਗ ਲੈਣ ਵਾਸਤੇ ਮੇਰੇ ਨਾਲ ਮੇਰੇ ਪਿੰਡ ਦੇ ਦੋ ਮੁੰਡੇ ਹੁੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਤਾਂ ਮੇਰੇ ਨਾਲ ਜਲਦੀ ਉੱਠ ਖੜ੍ਹਦਾ ਸੀ ਅਤੇ ਇੱਕ ਨੂੰ ਅਸੀਂ ਦੋਹੇਂ ਜਣੇ ਜਾਂਦੇ ਸੀ ਉਠਾਉਣ ਵਾਸਤੇ ਪਹਿਲਾਂ ਤਾਂ ਉਸਨੂੰ ਅੱਧੇ ਘੰਟੇ ਪਹਿਲਾਂ ਉਠਾਉਣਾ ਪੈਂਦਾ ਸੀ ਫੋਨ ਕਰਕੇ ਕਈ ਵਾਰ ਤਾਂ ਉਹ ਫੋਨ ਹੀ ਨਹੀਂ ਚੱਕਦਾ ਹੁੰਦਾ ਸੀਗਾ ਸਾਇਲੈਂਟ ਕਰਕੇ ਬਹਿ ਜਾਂਦਾ ਸੀ ਅਤੇ ਫੇਰ ਅਸੀਂ ਉਹਦੇ ਘਰੇ ਜਾਂਦੇ ਹੁੰਦੇ ਸੀ ਉਸ ਨੂੰ ਪਹਿਲਾਂ ਉਠਾਲਦੇ ਅਤੇ ਉਸਦਾ ਉਹ ਅੱਧਾ ਘੰਟਾ ਤਿਆਰ ਹੋਣ ਨੂੰ ਲਾ ਦਿੰਦਾ ਸੀ ਅਤੇ ਫੇਰ ਅਸੀਂ ਸਾਈਕਲ ਚੱਕਦੇ ਅਤੇ ਅਸੀਂ ਗਰਾਊਂਡ ਵੱਲ ਚਲੇ ਜਾਂਦੇ ਰਸਤੇ ਵਿੱਚ ਅਸੀਂ ਗਾਣੇ ਗਾ ਕੇ ਜਾਂਦੇ ਹੁੰਦੇ ਸੀ ਅਤੇ ਸਾਨੂੰ ਜਾਣ ਨੂੰ ਦਸ ਕੁ ਮਿੰਟ ਲੱਗ ਜਾਂਦੇ ਸੀ ਅਤੇ ਉਸ ਤੋਂ ਬਾਅਦ ਅਸੀਂ ਗਰਾਊਂਡ ਪਹੁੰਚਦੇ ਸਾਰ ਹੀ ਸਰ ਲੇਟ ਹੋ ਜਾਂਦੇ ਸੀ ਕਈ ਵਾਰ ਲੇਟ ਹੋ ਜਾਂਦੇ ਸੀ ਤਾਂ ਅਸੀਂ ਕੋਚ ਕੋਲੋਂ ਡੰਡੇ ਵੀ ਖਾਂਦੇ ਸੀ